ਪੰਜਾਬ ਨੂੰ ਕਾਫੀ ਤਿਉਹਾਰਾਂ ਦਾ ਦੇਸ਼ ਮੰਨਿਆ ਜਾਂਦਾ ਹੈ ਅਤੇ ਪੰਜਾਬ ਦੇ ਵਿੱਚ ਕਾਫੀ ਤਿਉਹਾਰ ਨੇ ਜਿਹੜੇ ਕਿ ਹਰੇਕ ਮਹੀਨੇ ਦੇਸੀ ਮਹੀਨੇ ਮਨਾਏ ਜਾਂਦੇ ਹਨ ਪੰਜਾਬ ਨੂੰ ਗੁਰੂਆਂ ਅਤੇ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਅਤੇ ਇਹਨਾਂ ਗੁਰੂਆਂ ਪੀਰਾਂ ਦੇ ਨਾਲ ਹੀ ਸੰਬੰਧਿਤ ਬਹੁਤ ਜ਼ਿਆਦਾ ਤਿਉਹਾਰ ਮਨਾਏ ਜਾਂਦੇ ਹਨ ਪੰਜਾਬ ਦੇ ਵਿੱਚ ਕਾਫੀ ਲੋਕ ਇੱਦਾਂ ਦੇ ਨੇ ਜੋ ਕਿ ਅਲੱਗ ਅਲੱਗ ਸ ਧਰਮਾਂ ਨਾਲ ਸੰਬੰਧ ਰੱਖਦੇ ਹਨ ਜਿਵੇਂ ਕਿ ਪੰਜਾਬ ਦੇ ਵਿੱਚ ਪੰਜਾਬੀ ਲੋਕ ਹਿੰਦੂ ਲੋਕ ਮੁਸਲਿਮ ਲੋਕ ਆਦਿ ਸਾਰੇ ਰਲ ਮਿਲ ਕੇ ਰਹਿੰਦੇ ਹਨ ਅਤੇ ਇਹਨਾਂ ਦਾ ਆਪਣਾ ਹੀ ਅਲੱਗ ਅਲੱਗ ਰਿਵਾਜ ਹੈ ਪੰਜਾਬ ਦੇ ਵਿੱਚ ਕਾਫੀ ਮੱਥੇ ਇੱਦਾਂ ਦੇ ਨੇ ਜੋ ਕਿ ਲੋਕ ਬਹੁਤ ਜ਼ਿਆਦਾ ਵਾਜਿਆਂ ਤਾਜਿਆਂ ਰੌਣਕ ਮੇਲੇ ਆਦੀਆਂ ਦੇ ਵਿੱਚ ਟੇਕਦੇ ਹਨ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਮੇਲਾ ਟੇਕਿਆ ਜਾਂਦਾ ਹੈ ਗੁਰੂਆਂ ਦੇ ਪੀਰਾਂ ਨਾਲ ਸੰਬੰਧਿਤ ਜਿਵੇਂ ਕਿ ਜਦੋਂ ਵੀ ਸਾਡਾ ਆਪਣਾ ਸਾਲ ਨਵਾਂ ਸਾਲ ਸ਼ੁਰੂ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਸਾਡੇ ਲੋਹੜੀ ਦਾ ਮੱਥਾ ਟੇਕਿਆ ਜਾਂਦਾ ਹੈ ਅਤੇ ਇੱਥੇ ਲੋਹੜੀ ਦੇ ਵਿੱਚ ਕਾਫੀ ਲੋਕ ਸ ਆਪਣਾ ਰਲ ਮਿਲ ਕੇ ਮੱਥਾ ਟੇਕਦੇ ਹਨ ਜਿਵੇਂ ਕਿ ਸਾਡੇ ਪਿੰਡ ਕੀ ਹੁੰਦਾ ਸਾਰੇ ਲੋਕ ਰਲ ਮਿਲ ਕੇ ਪਹਿਲਾਂ ਪੈਸੇ ਇਕੱਠੇ ਕਰਕੇ ਉਹਨਾਂ ਪੈਸਿਆਂ ਦਾ ਇਸਤੇਮਾਲ ਕਰਕੇ ਲੱਕੜਾਂ ਨੂੰ ਲਿਆਉਂਦੇ ਹਨ ਅਤੇ ਉਹਨਾਂ ਦਾ ਪੈਸਿਆਂ ਦਾ ਇਸਤੇਮਾਲ ਕਰਕੇ ਲੰਗਰ ਚਲਾਉਂਦੇ ਹਨ ਜਿਵੇਂ ਕਿ ਮੰਨਿਆ ਜਾਂਦਾ ਹੈ ਕਿ ਲੱਕੜ ਮਲ ਕਿ ਲੋਹੜੀ ਦੇ ਵਿੱਚ ਅਸੀਂ ਆਪਣੀਆਂ ਸਾਰੀ ਬੁਰਾਈਆਂ ਨੂੰ ਜਲਾ ਦਿੰਦੇ ਹਾਂ ਅਤੇ ਅਸੀਂ ਆਪਣਾ ਨਵਾਂ ਆਪਣੇ ਵਿੱਚ ਗੁਣ ਲਿਆਉਂਦੇ ਹਾਂ ਜਿਵੇਂ ਕਿ ਸਾਡੇ ਘਰ ਵਿੱਚ ਕੀ ਹੁੰਦਾ ਹੈ ਕਿ ਲੋਹੜੀ ਦਾ ਮੱਥਾ ਟੇਕਣ ਲਈ ਅਸੀਂ ਤਿਲਾਂ ਦਾ ਇਸਤੇਮਾਲ ਕਰਦੇ ਹਾਂ ਕਿ ਅਸੀਂ ਤਿਲ ਨਾਲ ਮੱਥਾ ਟੇਕਦੇ ਹਾਂ ਜਿਵੇਂ ਅਲੱਗ ਅਲੱਗ ਧਰਮਾਂ ਦੇ ਲੋਕ ਕੋਈ ਚੌਲਾਂ ਨਾਲ ਮੱਥਾ ਟੇਕਦਾ ਹੈ ਕੋਈ ਫੁੱਲੀਆਂ ਨਾਲ ਮੱਥਾ ਟੇਕਦਾ ਹੈ ਅਤੇ ਕਈ ਆਪਣਾ ਮੱਥਾ ਟੇਕਦੇ ਹਨ ਤਿਲਾਂ ਨਾਲ ਅਤੇ ਸਾਡੇ ਇੱਥੇ ਲੋਹੜੀ ਦਾ ਮੱਥਾ ਤਿਲਾਂ ਨਾਲ ਹੀ ਟੇਕਿਆ ਜਾਂਦਾ ਹੈ ਅਤੇ ਲੋਹੜੀ ਤੋਂ ਲੋਹੜੀ ਤੋਂ ਕੁਝ ਇੱਕ ਦਿਨ ਪਹਿਲਾਂ ਅਸੀਂ ਦੁੱਧ ਨੂੰ ਰਾੜ ਕੇ ਉਹਦਾ ਖੋਆ ਬਣਾਉਂਦੇ ਹਾਂ ਅਤੇ ਉਹਦਾ ਖੋਆ ਦਾ ਇਸਤੇਮਾਲ ਕਰਕੇ ਪਿੰਨੀਆਂ ਬਣਾਉਂਦੇ ਹਾਂ ਅਤੇ ਪਿੰਨੀਆਂ ਦੇ ਵਿੱਚ ਅਸੀਂ ਕਾਜੂ ਬਦਾਮ ਦਾਖਾਂ ਦੇ ਇਸਤੇਮਾਲ ਕਰਦੇ ਹਾਂ ਅਤੇ ਚੌਲਾਂ ਦੀਆਂ ਪਿੰਨੀਆਂ ਵੀ ਬਣਾਉਂਦੇ ਹਨ ਜੋ ਕਿ ਸਿਹਤ ਲਈ ਚੰਗੀਆਂ ਹੁੰਦੀਆਂ ਹਨ ਅਤੇ ਲੋਕਾਂ ਦੁਆਰਾ ਬਹੁਤ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਹਨ ਲੋਹੜੀ ਦੇ ਤਿਉਹਾਰ ਤੋਂ ਬਾਅਦ ਅੱਛਾ ਕਿ ਸਾਡੇ ਜਿਵੇਂ ਗੁਰਪੁਰਬ ਦਾ ਤਿਉਹਾਰ ਹੋ ਗਿਆ ਗੁਰਪੁਰਬ ਦੇ ਤਿਉਹਾਰ ਦੇ ਵਿੱਚ ਲੋਕ ਆਪਣੇ ਘਰਾਂ ਤੋਂ ਦੀਵੇ ਬਾਲ ਕੇ ਘਰਾਂ ਦੇ ਛੱਤਾਂ ਦੇ ਉੱਤੇ ਦੀਵੇ ਰੱਖਦੇ ਹਨ ਆਪਣੇ ਮੇਨ ਗੇਟ ਦੇ ਉੱਤੇ ਦੀਵੇ ਰੱਖਦੇ ਹਨ ਜੋ ਕਿ ਸਾਡਾ ਘਰ ਦਾ ਦਰਵਾਜ਼ਾ ਹੁੰਦਾ ਹੈ ਗੁ ਲੋਕ ਦੀਵਿਆਂ ਦੀਆਂ ਥਾਲੀਆਂ ਭਰ ਕੇ ਗੁਰਦੁਆਰੇ ਵਿੱਚ ਜਾਂਦੇ ਹਨ ਖੰਡਾ ਸਾਹਿਬ 'ਤੇ ਰੱਖਦੇ ਹਨ ਬਾਹਰ ਗੁਰਦੁਆਰੇ ਦੇ ਅੰਦਰ ਦੀਵੇ ਰੱਖਦੇ ਹਨ ਬਾਲ ਕੇ ਗੁਰਦੁਆਰੇ ਦੇ ਬਾਹਰ ਦੀਵੇ ਰੱਖਦੇ ਗੁਰਦੁਆਰੇ ਦੇ ਛੱਤਾਂ 'ਤੇ ਗੁਰਦੁਆਰੇ ਦੇ ਕੰਧਾਂ 'ਤੇ ਦੀਵੇ ਰੱਖਦੇ ਹਨ ਅਤੇ ਇਹ ਚ ਸ਼ਰਧਾ ਮੰਨੀ ਜਾਂਦੀ ਹੈ ਕਿ ਗੁਰਪੁਰਬ ਦਾ ਤਿਉਹਾਰ ਸਾਡੇ ਸਿੱਖਾਂ ਦੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਮਹੱਤਵਪੂਰਨ ਰੱਖਦਾ ਹੈ ਅਤੇ ਇਸ ਨੂੰ ਲੋਕ ਬਹੁਤ ਜ਼ਿਆਦਾ ਖੁਸ਼ੀਆਂ ਨਾਲ ਮਨਾਉਂਦੇ ਹਨ ਅਤੇ ਸਾਡੇ ਇੱਥੇ ਦੀਵੇ ਰੱਖਣ ਜਾਂਦੇ ਹਨ ਅਤੇ ਗੁਰਪੁਰਬ ਵਾਲੇ ਦਿਨ ਅਸੀਂ ਮਲ ਕਿ ਗੁਰਦੁਆਰੇ ਜਾ ਕੇ ਸਾਰਾ ਪਰਿਵਾਰ ਰਲ ਮਿਲ ਕੇ ਮੱਥਾ ਟੇਕ ਕੇ ਆਉਦੇ ਹਾਂ ਅਤੇ ਇਹ ਰੱਬ ਨੂੰ ਕਹਿੰਦੇ ਹਾਂ ਕਿ ਸਾਨੂੰ ਵੀ ਸ਼ਕਤੀ ਦੇਈਂ ਕਿ ਅਸੀਂ ਆਪਣੇ ਧਰਮ ਨੂੰ ਬਰਕਰਾਰ ਰੱਖ ਸਕੀਏ ਅਤੇ ਅਸੀਂ ਆਪਣੇ ਗੁਰੂਆਂ ਦੀ ਬਾਣੀਆਂ 'ਤੇ ਚੱਲੀਏ ਅਤੇ ਅਸੀਂ ਗੁ ਕਈ ਲੋਕ ਗੁਰਪੁਰਬ ਵਾਲੇ ਦਿਨ ਬੰਬ ਪਟਾਕੇ ਵਗੈਰਾ ਵੀ ਚਲਾਉਂਦੇ ਹਨ ਸਾਡੇ ਇੱਥੇ ਇਹ ਸਾਡੇ ਪਰਿਵਾਰ ਦੇ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਪਟਾਕਿਆਂ ਤੋਂ ਬਿਨਾਂ ਗੁਰਪੁਰਬ ਅਧੂਰਾ ਹੈ ਅਤੇ ਇਸ ਕਰਕੇ ਅਸੀਂ ਸਾਰਾ ਪਰਿਵਾਰ ਰਲ ਕੇ ਗੁਰਪੁਰਬ 'ਤੇ ਪਟਾਕਿਆਂ ਜਲਾਉਂਦੇ ਹਾਂ ਅਤੇ ਮੇਰੇ ਪਾਪਾ ਮੇਰੇ ਮੰਮੀ ਅਤੇ ਡੈਡੀ ਵੱਲੋਂ ਸਭ ਤੋਂ ਵੱਧ ਮ ਮੰਨਿਆ ਜਾਂਦਾ ਹੈ ਕਿ ਪਟਾਕੇ ਵਜਾਉਣੇ ਅਤੇ ਉਹ ਆਪਣੇ ਆਪਣੇ ਢੰਗ ਨਾਲ ਪਟਾਕੇ ਵਜਾਉਂਦੇ ਹਨ ਜਿਵੇਂ ਕਿ ਮੇਰੀ ਮੰਮੀ ਬੰਬਾਂ ਨੂੰ ਅੱਗ ਲਗਾ ਕੇ ਹੱਥ ਦੇ ਵਿੱਚ ਅੱਗ ਲਗਾ ਕੇ ਨਾਲ ਦੀ ਨਾਲ ਸੁੱਟ ਦਿੰਦੇ ਹਨ ਅਤੇ ਅਸੀਂ ਬਹੁਤ ਸਾਰੇ ਬੰਬਾਂ ਦਾ ਯੂਜ ਕਰਦੇ ਹਾਂ ਤੇ ਗੁਰੂਆਂ ਜੀ ਦੇ ਜਨਮ ਦਿਹਾੜੇ 'ਤੇ ਵੀ ਅਸੀਂ ਅਲੱਗ ਅਲੱਗ ਤਰੀਕੇ ਦਾ ਪਕਵਾਨ ਬਣਾਉਦੇ ਹਾਂ ਅਤੇ ਉਹਨਾਂ ਨੂੰ ਇਹ ਪਕਵਾਨ ਸਮੁੰਦਿਤ ਕਰਕੇ ਅਸੀਂ ਮੱਥਾ ਟੇਕਦੇ ਹਾਂ ਅਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਅਤੇ ਗੁਰਦੁਆਰੇ ਜਾ ਕੇ ਵੀ ਦੇਗ ਦਾ ਮੱਥਾ ਟੇਕ ਕੇ ਆਉਂਦੇ ਹਾਂ ਅਤੇ ਇੱਥੇ ਜਿਵੇਂ ਸਾਡੇ ਗੁੱਗੇ ਗੁੱਗਾ ਪੀਰ ਮਾੜੀ ਲਾਲਾਂ ਵਾਲੇ ਪੀਰ ਦੇ ਮੱਥਾ ਟੇਕਿਆ ਜਾਂਦਾ ਹੈ ਜਿਵੇਂ ਕਿ ਸਾ ਸਾਵਨ ਮਹੀਨੇ ਦੇ ਵਿੱਚ ਗੁੱਗਾ ਪੀਰ 'ਤੇ ਮੱਥਾ ਟੇਕਿਆ ਜਾਂਦਾ ਹੈ ਅਤੇ ਇਸ ਮੇਲੇ ਦੇ ਵਿੱਚ ਮੇਲੇ ਤੋਂ ਪਹਿਲਾਂ ਰੱਖੜੀ ਦਾ ਤਿਉਹਾਰ ਆਉਂਦਾ ਅਤੇ ਇਸ ਰੱਖੜੀ ਵਾਲੇ ਦਿਨ ਭੈਣ ਅਤੇ ਭਰਾ ਆਪਸ ਦੇ ਵਿੱਚ ਮਿਲ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਨ ਭੈਣ ਆਪਣੇ ਭਾਈ ਦੇ ਗੁੱਟ ਉੱਤੇ ਰੱਖੜੀ ਬੰਨ੍ਹਦੀ ਹੈ ਅਤੇ ਉਹਦੀ ਸਿਹਤ ਚੰਗੀ ਸਿਹਤ ਲਈ ਉਹਨੂੰ ਸਾਰੀਆਂ ਚੀਜ਼ਾਂ ਤੋਂ ਬਚਾਉਣ ਲਈ ਕੋਈ ਵੀ ਜੇ ਬੁਰਾਈ ਆ ਉਸ ਚੀਜ਼ ਤੋਂ ਬਚਾਉਣ ਲਈ ਦੁਆ ਕਰਦੀ ਹੈ ਅਤੇ ਭਾਈ ਆਪਣੀ ਭੈਣ ਨੂੰ ਸਿਰ 'ਤੇ ਹੱਥ ਰੱਖ ਕੇ ਆਸ਼ੀਰਵਾਦ ਦਿੰਦਾ ਹੈ ਕਿ ਮੈਂ ਤੈਨੂੰ ਸਦਾ ਸੁਰੱਖਿਅਤ ਰੱਖਾਂਗਾ ਅਤੇ ਜਿਵੇਂ ਕੁਝ ਤੋਹਫਾ ਵਗੈਰਾ ਪੈਸੇ ਵਗੈਰਾ ਆਦਿ ਦੇ ਦਿੰਦੇ ਹਨ ਅਤੇ ਆਪਸ ਦੇ ਵਿੱਚ ਲੋਕ ਪੰਜਾਬ 'ਚ ਇਸ ਤਿਉਹਾਰ ਨੂੰ ਬਹੁਤ ਮਨਾਉਂਦੇ ਹਨ ਅਤੇ ਇਸ ਤਿਉਹਾਰ ਵਾਲੇ ਦਿਨ ਉਹ ਆਪਸ ਦੇ ਵਿੱਚ ਬਹੁਤ ਜ਼ਿਆਦਾ ਫੋਟੋਆਂ ਵੀ ਖਿਚਵਾਉਂਦੇ ਹਨ ਆਪਸ ਦੇ ਵਿੱਚ ਰਲ ਮਿਲ ਕੇ ਸਾਰਾ ਪਰਿਵਾਰ ਰਲ ਮਿਲ ਕੇ ਇਸ ਤਿਉਹਾਰ ਨੂੰ ਮਨਾਉਂਦਾ ਹੈ ਅਤੇ ਗੁੱਗੇ ਪੀਰ ਦੇ ਮੇਲੇ ਦੇ ਵਿੱਚ ਅਸੀਂ ਸੇਵੀਆਂ ਦਾ ਮੱਥਾ ਟੇਕਦੇ ਹਾਂ ਗੁੱਗਾ ਪੀਰ ਜੀ ਕੋਲ ਸੇਵੀਆਂ ਦਾ ਮੱਥਾ ਟੇਕਦੇ ਹਾਂ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਇਸ ਮੇ ਇਸ ਦਿਨ ਤਿਉਹਾਰ ਦੇ ਮੌਕੇ ਮਾੜੀ 'ਤੇ ਮੇਲਾ ਵੀ ਲੱਗਦਾ ਹੈ ਜੋ ਕਿ ਜਿੱਥੇ ਲੋਕ ਆਪਸ ਵਿੱਚ ਰਲ ਮਿਲ ਕੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਦੇ ਹਨ ਆਪਣੇ ਪੁਰਾਣੇ ਗਵਾਂ ਪੁਰਾਣੇ ਗਵਾਂਢੀਆਂ ਨੂੰ ਆਪਣੇ ਰਿਸ਼ਤੇਦਾਰ ਨੂੰ ਸਭ ਨੂੰ ਆਪਣੇ ਘਰੇ ਸੱਦਦੇ ਹਨ ਅਤੇ ਰਲ ਮਿਲ ਕੇ ਇਸ ਤਿਉਹਾਰ ਦਾ ਆਨੰਦ ਮਾਣਦੇ ਹਨ ਅਤੇ ਬਾਕੀ ਬਹੁਤ ਜ਼ਿਆਦਾ ਤਿਉਹਾਰ ਹਨ ਜਿਹੜੇ ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਧੂਮਧਾਮ ਨਾਲ ਮਨਾਏ ਜਾਂਦੇ ਹਨ ਗੁਰੂਆਂ ਦੇ ਤਿਉਹਾਰ ਹੋ ਗਏ ਪੀਰਾਂ ਦੇ ਤਿਉਹਾਰ ਹੋ ਗਏ ਅਲੱਗ ਅਲੱਗ ਲੋਕਾਂ ਦੇ ਆਪਣੇ ਆਪਣੇ ਤਿਉਹਾਰ ਹੋ ਗਏ ਜਿਵੇਂ ਹਿੰਦੂ ਧਰਮ ਦੇ ਵਿੱਚ ਕੁਝ ਤਿਉਹਾਰ ਇੱਦਾਂ ਦੇ ਹੁੰਦੇ ਹਨ ਜਿਹਦੇ ਵਿੱਚ ਸਿਰਫ ਘਰ ਦੇ ਮੁੰਡੇ ਘਰ ਦੀਆਂ ਨੂੰਹਾਂ ਘਰ ਅਤੇ ਬਾਕੀ ਜੀਅ ਮੱਥਾ ਟੇਕ ਸਕਦੇ ਹਨ ਅਤੇ ਕਈ ਮੱਥੇ ਇੱਦਾਂ ਦੇ ਹੁੰਦੇ ਨੇ ਜਿਹਦੇ 'ਚ ਘਰ ਦੀਆਂ ਕੁੜੀਆਂ ਇਸ ਮੱਥੇ ਵਿੱਚ ਸ਼ਾਮਿਲ ਨਹੀਂ ਹੋ ਸਕਦੀਆਂ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਮੱਥੇ ਨੂੰ ਸਿਰਫ ਘਰ ਦੇ ਜੀਅ ਟੇਕ ਸਕਦੇ ਹਨ ਕਿਉਂਕਿ ਕੁੜੀਆਂ ਆਪਣੇ ਉਹਨਾਂ ਦਾ ਅਸਲੀ ਘਰ ਇਹ ਨਹੀਂ ਹੁੰਦਾ ਇਸ ਕਰਕੇ ਕੁੜੀਆਂ ਤੋਂ ਇਹ ਮੱਥਾਂ ਨਹੀਂ ਟੇਕਵਾਇਆ ਜਾਂਦਾ ਅਤੇ ਹਰੇਕ ਤਿਉਹਾਰ ਹੋ ਗਿਆ ਕੋਈ ਵੀ ਸਾ ਪ੍ਰੋਗਰਾਮ ਹੋ ਗਿਆ ਉਹਨਾਂ ਪ੍ਰੋਗਰਾਮਾਂ ਤੋਂ ਪਹਿਲਾਂ ਵੀ ਮੱਥੇ ਟੇਕੇ ਜਾਂਦੇ ਹਨ ਜਿਵੇਂ ਕਿ ਜਦੋਂ ਮੁੰਡੇ ਜਾਂ ਕੁੜੀ ਦਾ ਵਿਆਹ ਹੁੰਦਾ ਉਸ ਵਿਆਹ ਤੋਂ ਪਹਿਲਾਂ ਵੀ ਕੁਝ ਮੱਥਾ ਇੱਦਾਂ ਦਾ ਹੁੰਦਾ ਜਿਹੜੇ ਕਿ ਸਿਰਫ ਮੁੰਡੇ ਅਤੇ ਕੁੜੀ ਦੁਆਰਾ ਜਾਂ ਉਹਨਾਂ ਦੇ ਮਾਤਾ ਪਿਤਾ ਦੁਆਰਾ ਟੇਕਿਆ ਜਾਂਦਾ ਹੈ ਜੋ ਕਿ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਲਈ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ